ਪੰਜਾਬ ਇੱਕ ਖੇਤੀਬਾੜੀ ਵਾਲਾ ਰਾਜ ਹੈ ਇੱਥੇ ਦੇ ਲੋਕ ਆਪਣਾ ਆਰਥਿਕ ਜੀਵਨ ਖੇਤੀਬਾੜੀ ਕਰਕੇ ਬਤੀਤ ਕਰਦੇ ਸੀ ਇਸ ਤੋਂ ਇਲਾਵਾ ਇੱਥੇ ਦੇ ਲੋਕ ਲੱਕੜਾਂ ਦਾ ਕੰਮ ਲੋਹੇ ਦਾ ਕੰਮ ਆਦਿ ਵੀ ਕਰਦੇ ਸੀ ਪਰ ਜੇ ਅੱਜ ਕੱਲ੍ਹ ਦੇਖਿਆ ਜਾਏ ਅੱਜ ਦਾ ਨੌਜਵਾਨ ਖੇਤੀਬਾੜੀ ਅਤੇ ਇਹਨਾਂ ਕੰਮਾਂ ਤੋਂ ਹੱਟ ਕੇ ਦੂਜੇ ਕੰਮ ਵੱਲ ਵੱਧ ਰੁਚੀ ਰੱਖਦਾ ਹੈ ਜਿਵੇਂ ਉਹ ਆਪਣਾ ਬਿਜਨਸ ਪਾ ਲੈਂਦੇ ਹਨ ਉਹ ਸਰਕਾਰੀ ਨੌਕਰੀ ਵੱਲ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਉਹ ਵੱਡੀ ਵੱਡੀ ਕੰਪਨੀਆਂ ਦੇ ਵਿੱਚ ਪ੍ਰਾਈਵੇਟ ਨੌਕਰੀ ਵੱਲ ਵੀ ਧਿਆਨ ਦਿੰਦੇ ਹਨ ਜਿਸ ਨਾਲ ਉਹ ਆਪਣਾ ਜ਼ਿੰਦਗੀ ਦਾ ਆਰਥਿਕ ਜੀਵਨ ਬਤੀਤ ਕਰਦੇ ਹਨ ਜੇ ਐ ਦੇਖਿਆ ਜਾਏ ਤਾਂ ਐ ਵੀ ਕਾਫੀ ਵਧੀਆ ਹੈ ਕਿਉਂਕਿ ਇਸ ਨੂੰ ਕਾਫੀ ਵਧੀਆ ਆਰਥਿਕ ਸੰਪਤੀ ਬਣਾ ਲੈਂਦੇ ਹਨ ਜਿੱਦਾਂ ਜੇ ਉਹ ਵਧੀਆ ਦੁਕਾਨ ਆਪਣੀ ਚਲਾਉਣ ਤਾਂ ਉਹਨਾਂ ਨੂੰ ਕਾਫੀ ਪੈਸਾ ਵੀ ਆਉਂਦਾ ਹੈ ਇਸ ਤੋਂ ਇਲਾਵਾ ਉਹ ਵੱਡੇ ਵੱਡੇ ਬ੍ਰਾਂਡਾ ਨਾਲ ਆਪਣਾ ਟਾਏ ਅਪ ਕਰਕੇ ਵੱਡੇ ਸ਼ੋਰੂਮ ਖੋਲ੍ਹ ਲੈਂਦੇ ਹਨ ਅਤੇ ਆਪਣੇ ਜੀਵਨ ਵਧੀਆ ਤਰੀਕੇ ਨਾਲ ਬਤੀਤ ਕਰਦੇ ਹਨ